ਹੈਲੋ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਜਗਦੀਸ਼ ਕੁਮਾਰੀ ਮੈਂ ਤੁਹਾਨੂੰ ਸਰਕਾਰੀ ਭਾਸ਼ਾਵਾਂ ਕਿਹੜੀਆਂ ਹਨ ਦੱਸਣਾ ਚਾਹੁੰਦੀ ਹਾਂ ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਹਿੰਦੀ ਅੰਗਰੇਜ਼ੀ ਹੈ ਦੇਸ਼ ਭਰ ਵਿੱਚ ਵੱਖ ਵੱਖ ਖੇਤਰ ਵਿੱਚ ਖੇਤਰ ਹਨ ਖੇਤਰ ਵਿੱਚ ਵੱਖ ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਵੇਂ ਕਿ ਬੰਗਾਲੀ ਪੰਜਾਬੀ ਮਰਾਠੀ ਕਨਾਡਾ ਤੇਲਗੂ ਭਾਰਤ ਦੇਸ਼ ਵਿੱਚ ਵੱਖ ਵੱਖ ਸੱਭਿਆਚਾਰ ਦੇ ਲੋਕ ਰਹਿੰਦੇ ਹਨ ਰਹਿੰਦੇ ਹਨ ਜਿਸ ਕਾਰਨ ਉਹਨਾਂ ਭਾਸ਼ਾਵਾਂ ਵਿੱਚ ਵੀ ਕਾਫੀ ਵਿਭਿੰਨਤਾ ਹੈ ਪਰ ਸਭ ਇੱਕ ਦੇਸ਼ ਸਭ ਇਸ ਦੇਸ਼ ਦੇ ਰਹਿਣ ਵਾਲੇ ਹਨ ਅਤੇ ਸਭ ਮਿਲ ਕੇ ਰਹਿੰਦੇ ਹਨ ਹਰ ਭਾਸ਼ਾ ਆਪਣੇ ਆਪ ਵਿੱਚ ਸਤਿਕਾਰਯੋਗ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕੋ ਜਿਹਾ ਇੱਕੋ ਜਿਹੀ ਭਾਸ਼ਾ ਬੋਲਣੀ ਚਾਹੀਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਰਹਿਣਾ ਚਾਹੀਦਾ ਹੈ ਸਾਰਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਾਰੀਆਂ ਭਾਸ਼ਾ ਭਾਸ਼ਾਵਾਂ ਮਹਾਨ ਹੁੰਦੀਆਂ ਹਨ